ਮੈਂ ਆਪਣੇ ਪਰਿਵਾਰ ਦੇ ਨਾਲ ਘਰ ਦੇ ਹਰ ਇੱਕ ਤਿਉਹਾਰ ਨੂੰ ਔਰ ਹਰੇਕ ਵਿਆਹ ਸ਼ਾਦੀ ਜਨਮਦਿਨ ਨੂੰ ਬੜੀ ਬਖੂਬੀ ਔਰ ਬਹੁਤ ਵਧੀਆ ਤਰੀਕੇ ਨਾਲ ਮਨਾਉਂਦੀ ਹਾਂ ਜੇ ਗੱਲ ਕਰੀਏ ਆਪਣੇ ਪਰਿਵਾਰ ਦੇ ਨਾਲ ਮਨਾਏ ਹੋਏ ਕਿਸੇ ਜਸ਼ਨ ਬਾਰੇ ਅਤੇ ਕੁਛ ਟਾਇਮ ਪਹਿਲਾਂ ਮੇਰੀ ਜੇਠਾਣੀ ਦੀ ਕੁੜੀ ਦਾ ਵਿਆਹ ਹੋਇਆ ਔਰ ਉਸਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਉਹਦੇ ਲਈ ਤਿਆਰੀਆਂ ਬਹੁਤ ਛੋਟੀਆਂ ਛੋਟੀਆਂ ਤਿਆਰੀਆਂ ਕੀਤੀਆਂ ਉਹਦੇ ਤਿਹਾ ਉਹਦੇ ਫੰਕਸ਼ਨ ਦੇ ਵਿੱਚ ਹੋਣ ਵਾਲੀਆਂ ਹਰ ਇੱਕ ਐਕਟੀਵਿਟੀਜ ਦੇ ਵਿੱਚ ਅਸੀਂ ਜੋ ਜੋ ਕਰਨਾ ਸੀ ਉਹਦੀ ਅਸੀਂ ਪਹਿਲਾਂ ਹੀ ਲਿਸਟ ਬਣਾਈ ਸੀ ਜਿਹਦੇ ਵਿੱਚ ਸਾਡੇ ਜਦ ਅਸੀਂ ਸਾਡਾ ਸ਼ ਤਿਉਹਾਰ ਵਿਆਹ ਦੇ ਦਿਨ ਜਿਵੇਂ ਜਿਵੇਂ ਲਾਗੇ ਆ ਰਹੇ ਨੇ ਸੀ ਅਸੀਂ ਹਰ ਸਾਡੀ ਉਸਤਤਾ ਵੀ ਵਧ ਰਹੀ ਸੀ ਕਿਉਂਕਿ ਸਾਨੂੰ ਬਹੁਤ ਹੀ ਸੀਗੇ ਨਵੇਂ ਨਵੇਂ ਕੱਪੜੇ ਪਾਉਣੇ ਘਰ ਦੇ ਵਿੱਚ ਰੌਣਕ ਮੇਲਾ ਲੱਗਣਾ ਪਰਿਵਾਰ ਦੇ ਰਿਸ਼ਤੇ ਨਾਤੇ ਸਾਂਝੇ ਸ ਮਤਲਬ ਰਿਸ਼ਤੇਦਾਰਾਂ ਨੇ ਆਉਣਾ ਔਰ ਬਹੁਤ ਹੀ ਇੱਕ ਇੱਕ ਬਹੁਤ ਹੀ ਖੁਸ਼ਨੁਮਾ ਮਾਹੌਲ ਬਣ ਜਾਂਦਾ ਹੈ ਔਰ ਉਸ ਵਿਆਹ ਦੇ ਵਿੱਚ ਮੇਰੀ ਘਰ ਦੇ ਵਿੱਚ ਮੇਰੀਆਂ ਨਨਾਨਾਂ ਆਈਆਂ ਜਿਹਨਾਂ ਨਾਲ ਬਹੁਤ ਚਿਰਾਂ ਬਾਅਦ ਅਸੀਂ ਮਿਲੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਬਹੁਤ ਸਾਰੇ ਤੋਹਫੇਸ ਅਸੀਂ ਉਹਨਾਂ ਨੂੰ ਦਿੱਤੇ ਉਹ ਸਾਡੇ ਲਈ ਲੈ ਕੇ ਆਏ ਔਰ ਉਸ ਤੋਂ ਬਾਅਦ ਜਿਦ ਜਿਵੇਂ ਉਸ ਤੋਂ ਬਾਅਦ ਸਾਡੇ ਕੀਰਤਨ ਹੋਇਆ ਕੀਰਤਨ ਵਿੱਚ ਸਾਰੇ ਇਕੱਠੇ ਹੋਏ ਕਾਫੀ ਖੂਬ ਸਾਰਾ ਖਾਧਾ ਪੀਤਾ ਔਰ ਡਾਂਸ ਇੰਜੋਏਮੈਂਟ ਕੀਤਾ ਜਾਗੋ ਕੱਢੀ ਔਰ ਬਹੁਤ ਸਾਰਾ ਇੰਜੋਏਮੈਂਟ ਅਸੀਂ ਭੰਗੜਾ ਗਿੱਧਾ ਪਾ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਬਹੁਤ ਆਪਣੇ ਦਿਲ ਦੀਆਂ ਹਰ ਇੱਕ ਟੈਨਸ਼ਨ ਫਰੀ ਹੋ ਕੇ ਆਪਣਾ ਅਤੇ ਆਪਣਾ ਫੰਕਸ਼ਨ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਔਰ ਵਿਆਹ ਵਾਲੇ ਦਿਨ ਅਸੀਂ ਤਿਆਰ ਹੋਏ ਬਹੁਤ ਸਭ ਸਾਰੇ ਸਭ ਤੋਂ ਵੱਧ ਇਹ ਸੋਹਣੇ ਇੱਕ ਤੋਂ ਇੱਕ ਸੋਹਣਾ ਲੱਗ ਰਿਹਾ ਸੀ ਔਰ ਸਭ ਜਾਣੇ ਖੁਸ਼ ਸੀ ਔਰ ਨਾਲ ਦੇ ਨਾਲ ਸਾਨੂੰ ਇਹ ਬਹੁਤ ਸੀਗੀ ਕਿਉਂਕਿ ਅਸੀਂ ਬਹੁਤ ਚਿਰਾਂ ਬਾਅਦ ਹੀ ਇੱਕ ਸਾਰੇ ਜਾਣੇ ਇਕੱਠੇ ਹੋਏ ਸੀ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅਸੀਂ ਆਪਣਾ ਇਹ ਫੰਕਸ਼ਨ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਨਾਇਆ ਔਰ ਮੈਂ ਬਹੁਤ ਖੁਸ਼ ਹਾਂ ਔਰ ਮੇਰਾ ਸਭ ਤੋਂ ਵਧੀਆ ਸਨ ਇਹ ਤਜ਼ਰਬਾ ਵੀ ਇਹ ਰਿਹਾ ਕਿ ਅਸੀਂ ਸਾਰਿਆਂ ਨੇ ਇਸਨੂੰ ਬਹੁਤ ਹੀ ਫਰੈਸ਼ ਮਾਇੰਡ ਹੋ ਕੇ ਔਰ ਅਪ ਸਾਰੀ ਕਰਕੇ ਆਪਣਾ ਇਹ ਫੰਕਸ਼ਨ ਇੰਜੋਏ ਕੀਤਾ